ਅੱਜ ਕੱਲ੍ਹ ਹਰ ਇੱਕ ਬੰਦਾ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦਾ ਹੈ ਆਪਣੇ ਕੰਮ ਦੀ ਮਾਲਕੀ ਉਹ ਆਪ ਕਰਨਾ ਚਾਹੁੰਦਾ ਹੈ ਅਤੇ ਖੁੱਲ੍ਹ ਕੇ ਕਾਰੋਬਾਰ ਕਰਨਾ ਚਾਹੁੰਦਾ ਹੈ ਜਿਸ ਨੂੰ ਅੰਗਰੇਜ਼ੀ ਦੇ ਵਿੱਚ ਇੰਟਰਪਨਰਸ਼ਿਪ ਕਿਹਾ ਜਾਂਦਾ ਹੈ ਇਸ ਨਾਲ ਇਸ ਦਾ ਆਪਣੇ ਦੇਸ਼ ਦੀ ਤਰੱਕੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਇਸ ਨਾਲ ਦੇਸ਼ ਦੇ ਵਿੱਚ ਪ੍ਰੋਡਕਟੀਵਿਟੀ ਬਹੁਤ ਵੱਡੇ ਸਕੇਲ 'ਤੇ ਇੰਕਰੀਜ ਹੁੰਦੀ ਹੈ ਚੀਜ਼ਾਂ ਦੇ ਦਾਮ ਵੀ ਘੱਟ ਜਾਂਦੇ ਹਨ ਜਿਵੇਂ ਕਿ ਮੈਂ ਤੁਹਾਨੂੰ ਇੱਕ ਉਦਾਹਰਣ ਦੇ ਨਾਲ ਸਮਝਾਵਾਂਗਾ ਵੀ ਜੇਕਰ ਕਿਸੇ ਪ੍ਰੋਡਕਟ ਨੂੰ ਸਿਰਫ਼ ਦੋ ਤੋ ਚਾਰ ਮੇਜਰ ਕੰਪਨੀਆਂ ਹੀ ਬਣਾ ਰਹੀਆਂ ਹਨ ਦੇਸ਼ ਦੇ ਵਿੱਚ ਤਾਂ ਉਸ ਪ੍ਰੋਡਕਟ ਦੀ ਮੋਨੋਪਲੀ ਉਸ ਚਾਰ ਕੰਪਨੀਆਂ ਦੇ ਹੱਥ ਦੇ ਵਿੱਚ ਹੀ ਰਹੇਗੀ ਜਿਸ ਨਾਲ ਉਸ ਦਾ ਦਾਮ ਹੈ ਜਿਹੜਾ ਉਹ ਚਾਰ ਕੰਪਨੀਆਂ ਹੀ ਡਿਸਾਈਡ ਕਰਨਗੀਆਂ ਅਤੇ ਉਸ ਦਾ ਦਾਮ ਕਿੰਨਾ ਵੀ ਜ਼ਿਆਦਾ ਰੱਖਿਆ ਜਾ ਸਕਦਾ ਹੈ ਅਤੇ ਜੇਕਰ ਆਪਣੇ ਯੂਥ ਨੂੰ ਸਹੀ ਰਿਸੋਰਸਿਸ ਮਿਲਣ ਅਤੇ ਫਾਨੈਂਸ਼ੀਅਲ ਹੈਲਪ ਮਿਲੇ ਤਾਂ ਉਹ ਵੀ ਆਪਣਾ ਇੱਕ ਕਾਰੋਬਾਰ ਖੋਲ੍ਹ ਸਕਦਾ ਹੈ ਅਤੇ ਉਸ ਪ੍ਰੋਡਕਟ ਨੂੰ ਉਹ ਵੀ ਛੋਟੇ ਲੈਵਲ ਦੇ ਉੱਤੇ ਬਣਾ ਸਕਦਾ ਹੈ ਜਿਸ ਨਾਲ ਉਸ ਦਾ ਦਾਮ ਨੀਚੇ ਡਿੱਗ ਸਕਦਾ ਹੈ ਅਤੇ ਜਿਸ ਨਾਲ ਦੇਸ਼ ਦੇ ਵਿੱਚ ਪ੍ਰੋਡਕਟੀਵਿਟੀ ਦੇ ਵਿੱਚ ਵੀ ਇੰਕਰੀਜ਼ ਆ ਸਕਦਾ ਹੈ ਅਤੇ ਦੇਸ਼ ਦੇ ਵਿੱਚ ਜੋਬਸ ਵੀ ਕ੍ਰੀਏਟ ਹੋ ਸਕਦੀਆਂ ਹਨ ਜੇਕਰ ਜੇਕਰ ਇੱਕ ਸਮੋਲ ਬਿਜ਼ਨਸਮੈਨ ਇੱਕ ਬਿਜ਼ਨਸ ਸ਼ੁਰੂ ਕਰਦਾ ਹੈ ਤਾਂ ਉਸ ਨੂੰ ਮੈਨ ਪਾਵਰ ਦੀ ਬਹੁਤ ਲੋੜ ਪੈਂਦੀ ਹੈ ਅਤੇ ਇਸ ਨਾਲੋਂ ਦੇਸ਼ ਦੇ ਵਿੱਚ ਜੋਬਸ ਵੀ ਇਮਪਰੂਵ ਹੋਣਗੀਆਂ ਅਤੇ ਪ੍ਰੋਡਕਟੀਵਿਟੀ ਵੀ ਇੰਪਰੂਵ ਹੋਊਗੀ ਚੀਜ਼ਾਂ ਦੇ ਰੇਟ ਵੀ ਘਟਣਗੇ ਅਤੇ ਮਾਰਕੀਟ ਵੀ ਇੰਕਰੀਜ ਹੋਊਗੀ ਅਤੇ ਦੇਸ਼ ਦੀ ਜੀ ਡੀ ਪੀ ਵੀ ਇੰਕਰੀਜ਼ ਹੋਊਗੀ